ਪੰਜਾਬ ਵਿੱਚ ਇਤਿਹਾਸਿਕ ਖੇਡਾਂ ਅਤੇ ਸੈਲਾਨੀਆਂ ਲਈ ਬਹੁਤ ਥਾਵਾਂ ਹਨ ਪਰ ਕ ਪਠਾਨਕੋਟ ਇੱਕ ਬਹੁਤ ਵਧੀਆ ਸ਼ਹਿਰ ਹੈ ਉੱਥੇ ਪਹਾੜ ਹਨ ਉਹਨਾਂ ਪਹਾੜਾਂ ਵਿੱਚ ਇੱਕ ਮਿੰਨੀ ਗੋਆ ਨਾਮ ਦਾ ਥਾਂ ਹੈ ਉੱਥੇ ਪਹਾੜੀਆਂ ਅਤੇ ਇੱਕ ਵਿਸ਼ਾਲ ਝੀਲ ਹੈ ਉੱਥੇ ਵਾਟਰ ਸਪੋਟਸ ਟਰੈਕਿੰਗ ਅਤੇ ਕੈਂਪਿੰਗ ਕੀਤੀ ਜਾ ਸਕਦੀ ਹੈ ਉਸ ਦੇ ਨਾਲ਼ ਸ਼ਾਹਪੁਰ ਕੰਡੀ ਡੈਮ ਵੀ ਹੈ ਉੱਥੇ ਵੀ ਪਹਾੜੀਆਂ ਹਨ ਝੀਲ ਹੈ ਔਰ ਉੱਚੇ ਉੱਚੇ ਪਹਾੜ ਹਨ ਉੱਥੇ ਵੀ ਇਨ੍ਹਾਂ ਖੇਡਾਂ ਨੂੰ ਖੇਡ ਕੇ ਆਨੰਦ ਮਾਣਿਆ ਜਾ ਸਕਦਾ ਹੈ